ਜਿਵੇਂ ਕਿ ਆਪਾਂ ਦੇਖ ਹੀ ਸਕਦੇ ਹਾਂ ਵੀ ਮੁਕਤਸਰ ਜ਼ਿਲ੍ਹੇ ਵਿੱਚ ਤਾਪਮਾਨ ਹੈਗਾ ਜਿਵੇਂ ਆਪਾਂ ਹੁਣ ਦਾ ਵੇਖੀਏ ਤਾਂ ਜਿਵੇਂ ਹੁਣ ਸਰਦੀਆਂ ਆਉਣ ਵਾਲੀਆਂ ਹੈਗੀਆਂ ਠੀਕ ਹੈ ਤਾਂ ਹੁਣ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਸੁਬਹਾ ਸੁਬਹਾ ਤਾਂ ਜਿਵੇਂ ਧੁੰਦ ਵਗੈਰਾ ਹੁੰਦੀ ਆ ਧੂੰਆਂ ਵਗੈਰਾ ਹੁੰਦਾ ਉਹਦੇ ਕਾਰਨ ਠੰਡ ਵਗੈਰਾ ਲੱਗ ਜਾਂਦੀ ਆ ਦੁਪਹਿਰ ਵੇਲੇ ਕੀ ਹੈਗਾ ਗਾ ਗਰਮੀ ਵਗੈਰਾ ਹੋ ਜਾਂਦੀ ਹੈ ਰਾਤ ਨੂੰ ਕੀ ਆ ਫਿਰ ਠੰਡ ਹੋ ਜਾਂਦੀ ਹੈਗੀ ਠੀਕ ਹੈ ਮੁਕਤਸਰ ਜ਼ਿਲ੍ਹੇ ਦੇ ਵਿੱਚ ਕੀ ਹੈਗਾ ਗਾ ਮੌਸਮ ਹੈਗਾ ਗਾ ਜਿਹੜਾ ਉਹ ਹੈ ਮੀਡੀਅਮ ਚੱਲ ਰਿਹਾ ਹੈਗਾ ਵੀ ਠੀਕ ਹੈ ਗਰਮੀਆਂ ਵੀ ਬਹੁਤ ਇਸ ਵਾਰ ਜਿਹੜੀ ਗਰਮੀ ਪਈ ਆ ਉਹ ਬਹੁਤ ਹੀ ਜ਼ਿਆਦਾ ਗਰਮ ਸੀਗੀ ਠੀਕ ਹੈ ਹਾੜਾਂ ਦੇ ਸੋਕੇ ਕਠੋਰ ਸਰਦੀਆਂ ਇਹਨਾਂ ਸਾਰਿਆਂ ਦਾ ਵੀ ਅਨੁਭਵ ਹੈਗਾ ਗਾ ਵੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਕੀ ਹੈਗਾ ਗਾ ਵੀ ਕਹਿੰਦੇ ਆ ਲੋਕ ਵੀ ਜਿੰਨੀ ਗਰਮੀ ਵੱਧ ਪੈਂਦੀ ਹੈਗੀ ਹੈਗੀ ਸਰਦੀ ਵੀ ਉਨੀ ਹੀ ਵੱਧ ਪੈਂਦੀ ਹੈਗੀ ਜਿਵੇਂ ਪਿਛਲੇ ਸਾਲ ਹੈਗਾ ਸਰਦੀਆਂ ਹੈਗੀਆਂ ਬਹੁਤ ਜ਼ਿਆਦਾ ਪਈਆਂ ਇਸ ਵਾਰ ਕੀ ਆ ਗਰਮੀਆਂ ਨੇ ਵੀ ਕੀ ਆ ਰਿਕਾਰਡ ਤੋੜ ਦਿੱਤਾ ਟੈਂਪਰੇਚਰ ਪੰਜਾਹ ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀਗਾ ਠੀਕ ਹੈ ਤਾਂ ਆ ਇਥੋਂ ਦੇ ਜਿਹੜੇ ਮੁਕਤਸਰ ਦੇ ਲੋਕ ਹੈਗੇ ਆ ਉਹਨਾਂ ਨੇ ਕੀ ਹੈ ਇਨ੍ਹਾਂ ਗਰਮੀਆਂ ਸਰਦੀਆਂ ਸੋਕਾ ਵਗੈਰਾ ਇਹਨਾਂ ਸਾਰਿਆਂ ਦਾ ਵੀ ਕੀ ਆ ਅਨੁਭਵ ਕੀਤਾ ਐਂਡ ਇਹ ਜਿਹੜਾ ਅਨੁਭਵ ਹੈਗਾ ਗਾ ਇਹ ਬਹੁਤ ਹੀ ਜ਼ਿਆਦਾ ਜਿਵੇਂ ਕਹਿ ਸਕਦੇ ਹਾਂ ਕਿ ਠੀਕ ਰਿਹਾ ਵੀ ਹੈ ਠੀਕ ਨਹੀਂ ਵੀ ਰਿਹਾ ਗਰਮੀਆਂ ਦੇ ਵਿੱਚ ਅਨੁਭਵ ਦਾ ਪਤਾ ਹੀ ਹੁੰਦਾ ਵੀ ਗਰਮੀਆਂ ਦੇ ਵਿੱਚ ਕੀ ਆ ਮੱਛਰ ਵਗੈਰਾ ਹੁੰਦੇ ਆ ਮੱਖੀਆਂ ਵਗੈਰਾ ਹੁੰਦੀਆਂ ਲਾਈਟ ਚਲੀ ਜਾਂਦੀ ਹੈਗੀ ਠੀਕ ਹੈ ਗਰਮੀਆਂ ਦੇ ਵਿੱਚ ਗਰਮੀ ਜ਼ਿਆਦਾ ਲੱਗਣ ਲੱਗ ਪੈਂਦੀ ਹੈਗੀ ਹੈਗੀ ਸਰਦੀਆਂ ਦੇ ਵਿੱਚ ਕੀ ਹੈ ਸਰਦੀਆਂ ਦੇ ਵਿੱਚ ਇੱਕ ਚੀਜ਼ ਹੈਗੀ ਆ ਵੀ ਅਗਰ ਲਾਈਟ ਵਗੈਰਾ ਜਾ ਵੜੇਂਦੀ ਹੈ ਸਰਦੀਆਂ ਦੇ ਵਿੱਚ ਲੋਕ ਕੰਬਲ ਵਗੈਰਾ ਦੇ ਵਿੱਚ ਪਏ ਪੈ ਜਾਂਦੇ ਹੈਗੇ ਠੀਕ ਹੈ ਤਾਂ ਅਸੀਂ ਆਪਣੀ ਜ਼ਿੰਦਗੀ ਦੌਰਾਨ ਮੌਸਮ ਵਿੱਚ ਤਬਦੀਲੀ ਵੇਖੀ ਹੈਗੀ ਜਿਵੇਂ ਦੋ ਹਜ਼ਾਰ ਚੌ ਪੰਦਰਾਂ ਦੇ ਵਿੱਚ ਆਪਾਂ ਗੱਲ ਕਰੀਏ ਬੀ ਜਦੋਂ ਦਿਵਾਲੀ ਸੀ ਉਸ ਟਾਈਮ ਚੌਦ੍ਹਾਂ ਪੰਦਰ੍ਹਾਂ ਦੇ ਵਿੱਚ ਉਦੋਂ ਠੰਡ ਪੈਣ ਲੱਗ ਪਈ ਸੀ ਮਤਲਬ ਠੰਡ ਪੈਣ ਲੱਗ ਪਈ ਸੀ ਲੋਕ ਸ਼ੋਲ ਵਗੈਰਾ ਲੈਣ ਲੱਗ ਪਏ ਸੀਗੇ ਠੀਕ ਹੈ ਜੈਕਟਸ ਵਗੈਰਾ ਪਾਉਣ ਲੱਗ ਪਏ ਸੀ ਬਟ ਹੁਣ ਤੇਈ ਚੋ ਚੌਵੀ ਦੇ ਵਿੱਚ ਕੀ ਹੈਗਾ ਗਾ ਵੀ ਲੋਕ ਹੈਗੇ ਹੈਗੇ ਦਿਵਾ ਇਸ ਵਾਰ ਜਿਹੜੀ ਦਿਵਾਲੀ ਹੈਗੀ ਹੈਗੀ ਉਹਦੇ ਵਿੱਚ ਕੀ ਹੈ ਲੋਕਾਂ ਨੇ ਕੋਈ ਜੈਕਟਸ ਵਗੈਰਾ ਕੋਈ ਸ਼ੋਲ ਵਗੈਰਾ ਨਹੀਂ ਲਏ ਗੇ ਇਸ ਵਾਰ ਦੀ ਜਿਹੜੀ ਦਿਵਾਲੀ ਸੀ ਉਹਦੇ ਉਸ ਦਿਵਾਲੀ ਦੇ ਵਿੱਚ ਕੀ ਹੈਗਾ ਗਾ ਗਰਮੀ ਸੀਗੀ ਠੀਕ ਹੈ ਲੋਕਾਂ ਨੇ ਕੋਈ ਸ਼ੋਲ ਵਗੈਰਾ ਨਹੀਂ ਲਏ ਸੀ ਕੋਈ ਜੈਕਟਸ ਵਗੈਰਾ ਨਹੀਂ ਪਾਈਆਂ ਹੋਈਆਂ ਸੀਗੀਆਂ ਠੀਕ ਹੈ ਕਈ ਵੀ ਜਿਵੇਂ ਹੁਣ ਗਰਮੀ ਹੋਊਗੀ ਤਾਂ ਲੋਕ ਪੱਖਾ ਵਗੈਰਾ ਵੀ ਛੱਡਣਗੇ ਕਈ ਸਟੇਟਾਂ ਦੇ ਵਿੱਚ ਕੀ ਹੈਗਾ ਏ ਸੀ ਵਗੈਰਾ ਵੀ ਹੈਗੇ ਆ ਸੋ ਮੁਕਤਸਰ ਜ਼ਿਲ੍ਹੇ ਵਿੱਚ ਮੌਸਮ ਦਾ ਤਾਪਮਾਨ ਹੈਗਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਤਬਦੀਲੀਆਂ ਆਈਆਂ